ਹਾਂਜੀ ਮੇਰੇ ਕੋਲ ਇੱਕ ਬਹੁਤ ਹੀ ਮਨਪਸੰਦ ਬੁੱਕਸ ਹੈ ਮੈਨੂੰ ਆਪਣੀ ਲਾਈਫ 'ਚ ਧਾਰਮਿਕ ਬੁੱਕਸ ਪੜ੍ਹਨ ਦਾ ਬਹੁਤ ਹੀ ਸ਼ੌਂਕ ਐ ਮੈਂ ਬਹੁਤ ਹੀ ਸਾਰੀਆਂ ਧਾਰਮਿਕ ਬੁੱਕਸ ਇਕੱਠੀਆਂ ਕੀਤੀਆਂ ਹੋਈਆਂ ਵਾ ਜੋ ਮੈਂ ਪੜ੍ਹਦੀ ਰਹਿੰਦੀ ਹਾਂ ਆਪਣੀ ਦਿਨ ਰੂਟੀਨ ਵਿੱਚ ਪੜ੍ਹਦੀ ਰਹਿੰਦੀ ਹਾਂ ਅਤੇ ਮੈਂ ਆਪਣੀ ਗੁਡੀਆ ਨੂੰ ਵੀ ਸਗੋ ਕਹਿੰਦੀ ਰਹਿੰਦੀ ਹਾਂ ਕਿ ਤੂੰ ਧਾਰਮਿਕ ਬੁੱਕ ਪੜ੍ਹਿਆ ਕਰ ਉਹ ਵੀ ਟਾਈਮ ਕੱਢ ਕੇ ਵਿੱਚੋਂ ਪੜ੍ਹ ਲੈਂਦੀ ਹੈ ਅਤੇ ਇੱਕ ਬਹੁਤ ਹੀ ਸ਼ਪੈਸ਼ਲ ਬੁੱਕ ਹੈਗੀ ਹੈ ਧਾਰਮਿਕ ਬੁੱਕ ਗੁਰੂ ਗੋਬਿੰਦ ਸਿੰਘ ਜੀ ਬਾਰੇ ਜੋ ਮੈਂ ਉਹਨੂੰ ਮਾਰਕੀਟ 'ਚ ਜਾ ਕੇ ਬੜੀ ਮੁਸ਼ਕਿਲ ਨਾਲ ਉਹਨੂੰ ਲੱਭਿਆ ਇੱਕ ਮਾਰਕੀਟ 'ਚ ਗਈ ਦੂਜੀ ਮਾਰਕੀਟ 'ਚ ਗਈ ਨਹੀਂ ਮਿਲੀਆਂ ਫਿਰ ਮੈਨੂੰ ਦੂਰ ਜਾ ਕੇ ਕਿਤੇ ਬਾਹਰੋਂ ਮੰਗਵਾਉਣੀ ਪਈ ਪਰ ਮੈਂ ਉਹ ਬੁੱਕਸ ਨੂੰ ਖਰੀਦ ਲਿਆ ਅਤੇ ਬੜੇ ਬੜੀ ਮੁਸ਼ਕਿਲ ਨਾਲ ਉਹਨੂੰ ਖਰੀਦਿਆ ਅਤੇ ਉਹਨੂੰ ਪੜ੍ਹਿਆ ਵੀ ਉਹ ਪੜ੍ਹਨ ਵਿੱਚ ਵੀ ਬਹੁਤ ਵਧੀਆ ਬਹੁਤ ਇੰਟਰਸਟਿੰਗ ਬੁੱਕ ਹੈ ਉਹਨੂੰ ਪੜ੍ਹ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਮੈਂ ਕਈ ਵਾਰੀ ਦਿਨ 'ਚ ਜਦੋਂ ਵਿਹਲੀ ਬੈਠੀ ਹੋਵਾਂ ਤਾਂ ਮੈਂ ਉਸ ਬੁੱਕਸ ਨੂੰ ਲੈ ਕੇ ਬਹਿ ਜਾਂਦੀ ਹਾਂ ਕਿ ਉਹ ਬੁੱਕਸ ਪੜ੍ਹਨਾ ਮੇਰੀ ਨਾਲ ਹੈਬਿਟ ਹੈਗੀ ਮੈਨੂੰ ਬੁੱਕਸ ਪੜ੍ਹਨਾ ਵਧੀਆ ਲੱਗਦਾ ਹੈ ਅਤੇ ਮੈਨੂੰ ਖੁਸ਼ੀ ਵੀ ਮਿਲਦੀ ਹੈ ਮੇਰਾ ਮਨ ਵੀ ਸ਼ਾਂਤ ਰਹਿੰਦਾ ਹੈ ਅਤੇ ਬਸ ਜਦੋਂ ਦਿਲ ਕਰੇ ਬੁੱਕਸ ਪੜ੍ਹ ਲਓ ਆਪਣਾ ਵਧੀਆ ਵਧੀਆ ਜੀਵਨ ਬਤੀਤ ਕਰਾਓ ਇਸੀ ਲਈ ਮੈਨੂੰ ਬੁੱਕਸ ਵਧੀਆ ਲੱਗਦੀਆਂ ਪੜ੍ਹਨੀਆਂ ਅਤੇ ਮੈਂ ਹੋਰ ਵੀ ਕਈ ਬੁੱਕਸਾਂ ਵੀ ਇਕੱਠੀਆਂ ਕੀਤੀਆਂ ਹੋਈਆਂ ਇੰਗਲਿਸ਼ ਪੰਜਾਬੀ ਦੀਆਂ ਹੋਰ ਵੀ ਬੁੱਕਸ ਪੜ੍ਹਦੀ ਰਹਿੰਦੀ ਹਾਂ ਪਰ ਫੇਵਰੇਟ ਬੁੱਕਸ ਮੇਰੀ ਧਾਰਮਿਕ ਬੁੱਕਸ ਹੈਗੀਆਂ ਗੁਰੂਆਂ ਬਾਰੇ ਹਿਸਟਰੀ ਦੀ ਵੀ ਨੋਲੇਜ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਦੀ ਹੈ